ਹੈਲੋ ਹਾਂ ਦਿਪਾਂਸ਼ੀ ਕਿਵੇਂ ਵਧੀਆ ਪਹਿਚਾਣ ਲਿਆ ਹਾਂ ਹਾਂ ਹੋਰ ਦੱਸ ਕਿਵੇਂ ਆਂ ਬਸ ਵਧੀਆ ਹੋਰ ਦੱਸ ਮੈਂ ਤਾਂ ਕੀਤਾ ਸੀਗਾ ਕਿ ਮੈਂ ਫਰੀਦਕੋਟ ਆਈ ਸੀਗੀ ਅਤੇ ਮੈਂ ਤੈਨੂੰ ਪੁੱਛਣਾ ਸੀਗਾ ਕਿ ਖਾਣ ਪੀਣ ਦਾ ਕੀ ਸਾਜੋ ਸਮਾਨ ਕਿੱਥੋਂ ਮਿਲਦਾ ਮੈਂ ਫਾਸਟ ਫੂਡ ਬਾਰੇ ਪੁੱਛਣਾ ਸੀ ਮੇਰੇ ਪਰਸਨਲ ਲਈ ਹਾਂ ਹਾਂ ਹਾਂ ਕੰਟੈਂਟ ਲਈ ਚਾਹੀਦਾ ਸੀਗਾ ਤੂੰ ਦੇਖੀਆਂ ਸੀ ਵੀਡੀਓਜ਼ ਹਾਂ ਕਰ ਫਿਰ ਕੋਈ ਜਗ੍ਹਾ ਰਿਕਮੈਂਡ ਅੱਛਾ ਅੱਛਾ

ਅੱਛਾ ਸਟੀਟ ਫੂਡ ਬੈਸ ਵਗੈਰਾ ਕਿੱਦਾਂ ਇੱਥੇ

ਅੱਛਾ ਅੱਛਾ ਠੀਕ

ਪੀਜਾ ਵਗੈਰਾ ਬਾਰੇ ਦੱਸਦੇ ਕੁਛ ਅੱਛਾ ਇੱਕ ਲਜ਼ੀਜ਼ ਪੀਜ਼ਾ ਆਈ ਥਿੰਕ ਨਾਮ ਆ ਉਹਨਾਂ ਦਾ ਕਦੇ ਗਈ ਵਿਜਿਟ ਕੀਤਾ ਕਦੇ ਅੱਛਾ ਠੀਕ ਆ ਮੈਂ ਕਿਹਾ ਚੱਲ ਮੈਂ ਤੇਰੇ ਤੋਂ ਸਲਾਹ ਲੈਂਦੀ ਹਾਂ ਮੈਂ ਕਿਹਾ ਚੱਲ ਮੈਂ ਤੈਨੂੰ ਪੁੱਛਦੀ ਹਾਂ ਤੂੰ ਤਾਂ ਇੱਥੋਂ ਦੀ ਲੋਕਲ ਹੀ ਹਾਂ ਮੈਂ ਤਾਂ ਫਿਰ ਕਦੇ ਕਦੇ ਆਉਂਦੀ ਹਾਂ ਮੈਂ ਕਿਹਾ ਚੱਲ ਤੇਰਾ ਤੇਰੀ ਸਲਾਹ ਲੈ ਲੈਂਦੀ ਹਾਂ ਹੁੰ ਹੁੰ ਹਾਂ ਚੱਲ ਕੋਈ ਨਹੀਂ ਮੈਂ ਤੈਨੂੰ ਕਰੂੰਗੀ ਕਾਲ ਜ਼ਰੂਰ ਹੋਰ ਕੋਈ ਹੋਰ ਕੀ ਕੀ ਚੀਜ਼ਾਂ ਗੋਲ ਗੱਪੇ ਵਗੈਰਾ ਹੁੰ ਹੁੰ ਅੱਛਾ ਠੀਕ ਹੈ ਚੱਲ ਕੋਈ ਨਹੀਂ ਫਿਰ ਮੈਂ ਜਦੋਂ ਆਈ ਨਾ ਮੈਂ ਤੈਨੂੰ ਕਾਲ ਕਰ ਦੂੰਗੀ ਹੈਲਪ ਕਰਦੀ ਮੇਰੀ ਨਾਲ ਮੈਂ ਤੈਨੂੰ ਜੇ ਕੁਛ ਪੁੱਛਣਾ ਹੋਇਆ ਤਾਂ ਮੈਂ ਕਾਲ ਕਰ ਲੂੰਗੀ ਤੈਨੂੰ ਹਾਂ ਠੀਕ